ਜਦੋਂ ਵੀ ਆਪਾਂ ਕਿਸੇ ਵੀ ਪ੍ਰਕਾਰ ਦਾ ਬਿਜਨਸ ਸਟਾਰਟ ਕਰਦੇ ਹਾਂ ਜਾਂ ਨਵਾਂ ਕਾਰੋਬਾਰ ਸਟਾਰਟ ਕਰਦੇ ਹਾਂ ਤਾਂ ਆਪਾਂ ਨੂੰ ਰਸਮੀ ਤੌਰ 'ਤੇ ਕਈ ਚੀਜ਼ਾਂ ਕਰਵਾਉਣੀਆਂ ਪੈਂਦੀਆਂ ਹਨ ਹਰੇਕ ਧਰਮ ਆਪਣੀ ਆਪਣੀ ਰਸਮ ਕਰਦਾ ਹੈ ਜਿਵੇਂ ਸਿੱਖਾਂ ਦੇ ਵਿੱਚ ਅਖੰਡ ਪਾਠ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਂਦਾ ਹੈ ਅਤੇ ਹਿੰਦੂ ਦੇ ਵਿੱਚ ਹਵਨ ਕਰਵਾਇਆ ਜਾਂਦਾ ਹੈ ਇਸ ਲਈ ਦੋ ਪ੍ਰਕਾਰ ਦੇ ਕਾਰੋਬਾਰ ਹਨ ਸ ਇੱਕ ਤਾਂ ਛੋਟੇ ਖੇਤਰ ਦੇ ਕਾਰੋਬਾਰ ਹਨ ਇੱਕ ਕੋਟਏਜ ਦੇ ਕਾਰੋਬਾਰ ਹਨ ਤਿੰਨ ਲੱਖ ਤੱਕ ਦੀ ਜਿਹੜੀ ਆਪਾਂ ਇਨਵੈਸਟਮੈਂਟ ਕਰਦੇ ਹਾਂ ਉਹ ਹੈਗਾ ਸਮਾਲ ਸਕੇਲ ਦੇ ਲਈ ਛੋਟੇ ਪੱਧਰ 'ਤੇ ਜਿਹੜੀ ਇੰਡਸਟਰੀਸ ਹੈ ਵੱਡੀ ਇੰਡਸਟਰੀਜ ਹੈ ਜਿਹੜੀ ਉਹ ਦਸ ਲੱਖ ਪਲੱਸ ਦਾ ਆਪਣਾ ਜਿਹੜਾ ਕੈਪੀਟਲ ਚਾਹੀਦਾ ਸੋ ਇਸ ਲਈ ਆਪਾਂ ਨੂੰ ਰਸਮਾਂ ਕਰਵਾਉਂਦੇ ਹਾਂ ਤਾਂ ਕਿ ਜੋ ਵੀ ਆਪਣਾ ਕਾਰੋਬਾਰ ਚੱਲਿਆ ਉਹ ਪੂਰਨ ਤੌਰ 'ਤੇ ਸਫਲ ਰਹੇ ਅਤੇ ਬਹੁਤ ਜ਼ਿਆਦਾ ਲੋਕਾਂ ਨੂੰ ਆਪਾਂ ਉਸ ਰਸਮ 'ਤੇ ਬੁਲਾਉਂਦੇ ਹਾਂ ਤਾਂ ਕਿ ਸਾਰਿਆਂ ਨੂੰ ਇਸ ਚੀਜ਼ ਬਾਰੇ ਜਾਣੂ ਕਰਵਾਇਆ ਜਾ ਸਕੇ ਰਸਮ ਜਿਹੜੀ ਹੈ ਅਖੰਡ ਪਾਠ ਸੁਖਮਨੀ ਸਾਹਿਬ ਪਾਠ ਕਰਵਾਇਆ ਜਾਂਦਾ ਹੈ ਤਾਂ ਕਿ ਆਪਣਾ ਕਾਰੋਬਾਰ ਨਵੇਂ ਸਿਰ ਤੋਂ ਵਧੀਆ ਤਰੀਕੇ ਨਾਲ ਸ਼ੁਰੂ ਹੋ ਸਕੇ ਅਤੇ ਹਮੇਸ਼ਾ ਲਈ ਉਹ ਸੁਖੀ ਸ਼ਾਤੀ ਆਪਣੇ ਘਰ ਪਰਿਵਾਰ ਵਿੱਚ ਬਣੀ ਰਹੇ ਅਤੇ ਕਾਰੋਬਾਰ ਨੂੰ ਵੱਧ ਤੋਂ ਵੱਧ ਅੱਗੇ ਲਿਜਾਇਆ ਜਾ ਸਕੇ ਜਿਵੇਂ ਕੀ ਹਰੇਕ ਚੀਜ਼ ਦਾ ਇੱਕ ਕਾਰਨ ਹੈ ਜਿਵੇਂ ਹਿੰਦੂ ਹਵਨ ਕਰਵਾਉਂਦੇ ਹਨ ਤਾਂ ਉਸ ਵਿੱਚ ਸਮੱਗਰੀ ਪਾਈ ਜਾਂਦੀ ਹੈ ਜਿਸ ਦਾ ਅਰਥ ਹੈ ਕਿ ਜੇ ਕੋਈ ਵੀ ਨੈਗਟਿਵਿਟੀ ਜਾਂ ਕਿਸੇ ਵੀ ਤਰ੍ਹਾਂ ਦਾ ਸ਼ੈਤਾਨਪਣ ਹੈ ਜਿਹੜਾ ਉਹ ਸਾਡੇ ਕਾਰੋਬਾਰ ਤੋਂ ਦੂਰ ਹੋ ਸਕੇ ਅਤੇ ਜੋ ਵੀ ਇੱਕ ਮਾਲਕ ਨੂੰ ਸਭ ਤੋਂ ਜ਼ਿਆਦਾ ਮੇਨ ਹੈ ਕਿਸੇ ਵੀ ਰਸਮ ਦਾ ਮਾਲਕ ਨੂੰ ਅੰਦਰੋਂ ਸੰਤੁਸ਼ਟ ਕਰਨਾ ਵੀ ਹਾਂ ਹੁਣ ਉਹਨੂੰ ਪੋਜਟਿਵ ਕਰ ਦਿੱਤਾ ਗਿਆ ਹੈ ਹਾਂ ਵੀ ਤੂੰ ਹੁਣ ਆਪਣਾ ਕਾਰੋਬਾਰ ਬਿਨਾਂ ਕਿਸੇ ਡਰ ਤੋਂ ਚਲਾ ਸਕਦਾ ਹੈ ਅਤੇ ਉਸਨੂੰ ਹੌਸਲਾ ਅਫਜਾਈ ਲਈ ਰਸਮਾਂ ਕਰਦੇ ਹਾਂ ਰਸਮਾਂ ਜਿਹੜੀਆਂ ਨਵੇਂ ਕਾਰੋਬਾਰ ਲਈ ਕੀਤੀਆਂ ਜਾਂਦੀਆਂ ਹਨ ਉਸ ਵਿੱਚ ਆਪਾਂ ਧੂਫ ਵੀ ਕਰਦੇ ਹਾਂ ਅਤੇ ਧੂਫ ਕਰਦੇ ਹਾਂ ਹਵਨ ਦੇ ਵਿੱਚ ਸਮੱਗਰੀ ਦਾ ਵਰਤੋਂ ਕੀਤਾ ਜਾਂਦਾ ਹੈ ਅਖੰਡ ਪਾਠ ਸੁਖਮਨੀ ਸਾਹਿਬ ਪਾਠ ਵੀ ਕਰਵਾਇਆ ਜਾਂਦਾ ਹੈ ਅਤੇ ਲੋਕਾਂ ਨੂੰ ਬਾਅਦ ਵਿੱਚ ਪ੍ਰਸ਼ਾਦ ਵੰਡ ਵੰਡਿਆ ਜਾਂਦਾ ਹੈ ਇਸ ਲਈ ਜੋ ਕਾਰੋਬਾਰ ਦਾ ਮਾਲਕ ਹੈ ਉਸ ਨੂੰ ਹੌਸਲਾ ਅਫਜਾਈ ਵੀ ਮਿਲਦੀ ਹੈ